ਅਸੀਂ ਜਾਣਦੇ ਹਾਂ ਕਿ ਪੰਜਾਬ ਵਿੱਚ ਬਹੁਤ ਤਰ੍ਹਾਂ ਦੇ ਖੇਤੀ ਵਿਭਾਗ ਹਨ ਜੋ ਕਿ ਸਾਨੂੰ ਨਵੇਂ ਨਵੇਂ ਤਰੀਕੇ ਨਾਲ ਖੇਤੀ ਕਰਨੀ ਦੱਸਦੇ ਹਨ ਜਿਸ ਨਾਲ ਕਿ ਨਵੇਂ ਕਿਸਾਨਾਂ ਨੂੰ ਅਤੇ ਨਵੀਂ ਫ਼ਸਲ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਜਿਵੇਂ ਕਿ ਔਰਗੈਨਿਕ ਖੇਤੀ ਨਾਲ ਜੋ ਕਿ ਖੇਤੀ ਦੀ ਪੈਦਾਵਾਰ ਨੂੰ ਵੀ ਵਧਾਉਂਦੀਆਂ ਹਨ ਅਤੇ ਕਿਸਾਨ ਦੇ ਮੁੱਲ ਨੂੰ ਵੀ ਪੂਰਾ ਕਰਦੀਆਂ ਹਨ ਇਸ ਨਾਲ ਫ਼ਸਲ ਦਾ ਝਾੜ ਵਧੀਆ ਆਉਂਦਾ ਅਤੇ ਫ਼ਸਲ ਵੀ ਵਧੀਆ ਹੁੰਦੀ ਹੈ ਜਿਸ ਨਾਲ ਕਿ ਪਹਿਲਾਂ ਜਮੀਨ ਦੇ ਟੈਸਟ ਅਤੇ ਵਾਤਾਵਰਨ ਦੇਖਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਦੀ ਜਮੀਨ 'ਤੇ ਖੇਤੀ ਅਤੇ ਕਿਸ ਚੀਜ਼ ਦੀ ਖੇਤੀ ਕੀਤੀ ਜਾ ਰਹੀ ਹੈ ਜਿਸ ਨਾਲ ਕਿ ਕਿਸਾਨ ਨੂੰ ਅੱਗੇ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਅਤੇ ਕਿਸਾਨ ਦਾ ਵੱਧ ਤੋਂ ਵੱਧ ਮੁਨਾਫ਼ਾ ਹੋ ਸਕੇ ਇਸ ਨਾਲ ਕਿਸਾਨ ਦੀ ਫ਼ਸਲ ਦਾ ਮੁੱਲ ਵੀ ਵੱਧ ਹੁੰਦਾ ਹੈ ਅਤੇ ਕਿਸਾਨ ਦੀ ਫ਼ਸਲ ਵੀ ਵਧੀਆ ਹੁੰਦੀ ਹੈ ਇਹ ਸੰਸਥਾਵਾਂ ਸਾਨੂੰ ਪੰਜਾਬ ਵਿੱਚ ਥਾਂ ਥਾਂ 'ਤੇ ਸ਼ੁਰੂ ਕਰਨੀਆਂ ਚਾਹੀਦੀਆਂ ਹਨ ਜਿਸ ਨਾਲ ਕਿ ਅੱਗੇ ਤੋਂ ਅੱਗੇ ਜਾਂ ਆਉਣ ਵਾਲੀ ਪੀੜ੍ਹੀ ਨੂੰ ਜਿਨ੍ਹਾਂ ਦਾ ਪਤਾ ਲੱਗੇ ਅਤੇ ਔਰਗੈਨਿਕ ਖੇਤੀ ਵੱਲ ਜਾਣ ਜਿਸ ਨਾਲ ਕਿ ਪੰਜਾਬ ਦੀ ਪੈਦਾਵਾਰ ਵਿੱਚ ਜਾਂ ਖੇਤੀਬਾੜੀ ਵਿਭਾਗ ਵਿੱਚ ਵੱਧ ਤੋਂ ਵੱਧ ਸਹੂਲਤਾਂ ਹੋਣ ਅਤੇ ਪੰਜਾਬ ਨੂੰ ਵੱਧ ਤੋਂ ਵੱਧ ਜ਼ਿਆਦਾ ਫਾਇਦਾ ਹੋਵੇ ਇਹ ਸੰਸਥਾਵਾਂ ਆਟੋਮੈਟਿਕ ਖੇਤੀ ਬਾਰੇ ਵੀ ਦੱਸਦੀਆਂ ਹਨ ਜਿਸ ਨਾਲ ਕਿ ਝਾੜ ਵੱਧ ਜਾਂਦਾ ਹੈ ਅਤੇ ਝਾੜ ਵੱਧ ਜਾਂਦਾ ਹੈ ਅਤੇ ਫ਼ਸਲਾਂ ਲੰਬੇ ਸਮੇਂ ਤੱਕ ਅਤੇ ਵਧੀਆ ਚੱਲਦੀਆਂ ਹਨ ਤਾਂ ਕਰਕੇ ਮੈਂ ਇਨ੍ਹਾਂ ਸੰਸਥਾਵਾਂ ਦੇ